ਬੈਂਕਾਂ ਵਿੱਚ ਸਾਡੇ ਖਿਆਲ ਵਿੱਚ ਬੈਂਕਾਂ ਵਿੱਚ ਬਹੁਤ ਸਾਰੀ ਚੁਣੌਤੀਆਂ ਆ ਚੁੱਕੀਆਂ ਹਨ ਜੋ ਕਿ ਬੈਂਕਾਂ ਵਿੱਚ ਕੰਮ ਬਹੁਤ ਵਧਿਆ ਹੋਇਆ ਹੈ ਜੋ ਕਿ ਇਸ ਕਰਕੇ ਕੰਮ ਵਧਿਆ ਹੋਇਆ ਜਿਹਨਾਂ 'ਤੇ ਕੰਮ ਆਇਆ ਹੋਇਆ ਹੈ ਜਿਵੇਂ ਕਿ ਜੋ ਕਿ ਕੰਮ ਕਰਾਉਣ ਜਾਂਦੇ ਹੈ ਬਹੁਤ ਲੇਟ ਹੋ ਜਾਂਦਾ ਹੈ ਜੋ ਕਿ ਉਹਨਾਂ ਨੂੰ ਕੰਮ ਐਕਸਟਰਾ ਬਹੁਤ ਕਰਨਾ ਪੈਂਦਾ ਹੈ ਜੋ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕੰਮ ਜੋ ਕਿ ਜਿੰਨਾ ਵੀ ਹੋਵੇ ਘਟਾਇਆ ਜਾਵੇ ਗਾਹਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਜਿੰਨਾ ਵੀ ਹੈ ਸੁਧਾਰ ਕੀਤਾ ਜਾਵੇ ਸਰਕਾਰ ਨੂੰ ਸਾਰਾ ਆਪਣਾ ਰੁਕਾਵਟਾਂ ਨੂੰ ਸੁਧਾਰ ਕਰਨਾ ਚਾਹੀਦਾ ਹੈ ਜੋ ਕਿ ਆਮ ਜਨਤਾ ਜੋ ਕਿ ਕੰਮ ਕਰਵਾਉਣ ਆਉਂਦੀ ਹੈ ਉਸਨੂੰ ਟਾਈਮ ਬਹੁਤ ਲੱਗ ਜਾਂਦਾ ਹੈ ਬੈਂਕਾਂ 'ਚ ਕਈ ਵਾਰੀ ਤਾਂ ਆਪਣਾ ਕੰਮ ਵੀ ਛੱਡ ਕੇ ਆਉਂਦੇ ਹਾਂ ਇਸ ਲਈਏ ਪਰੇਸ਼ਾਨ ਬਹੁਤ ਹੋ ਜਾਂਦੇ ਹਾਂ ਕੰਮ ਘੱਟ ਤੋਂ ਘੱਟ ਛੇਤੀ ਹੋਣਾ ਚਾਹੀਦਾ ਹੈ ਸਰਕਾਰ ਨੂੰ ਥੋੜ੍ਹਾ ਦੇਖਣਾ ਚਾਹੀਦਾ ਹੈ ਬੈਂਕਾਂ 'ਚ ਕੰਮ ਘਟਾਇਆ ਜਾਵੇ ਅਤੇ ਪਰੇਸ਼ਾਨੀਆਂ ਚਿੰਤਾ ਦੀ ਦੂਰ ਕੀਤੀ ਜਾਵੇ ਸਰਕਾਰ ਨੂੰ ਲਿਖਤੀ ਲੈਂਡ ਸਕ ਸਕੇਪ ਧਰਤੀ ਜੋਗੀ ਬੈ ਬਣੇ ਲੈਣ ਰਹਿਣ ਲਈ ਬਹੁਤ ਸਾਰੇ ਹੱਲ ਕਰਨੇ ਚਾਹੀਦੇ ਹਨ ਰੁਕਾਵਟਾਂ ਨੂੰ ਦੂਰ ਕਰਨਾ ਚਾਹੀਦਾ ਹਨ ਜੋ ਬੈਂਕਾਂ 'ਚ ਆਉਣ ਵਾਲੇ ਟਾਈਮ 'ਚ ਲੋਕਾਂ ਦੀ ਸੁਣਵਾਈ ਕਰਨੀ ਚਾਹੀਦੀ ਹੈ ਅਤੇ ਬਹੁਤ ਤੇਜ਼ੀ ਨਾਲ ਕੰਮ ਹੋਣਾ ਚਾਹੀਦਾ ਹੈ ਜ਼ਿਆਦਾ ਦੇਰ ਤੱਕ ਬੈਠਣ ਅਤੇ ਟਾਈਮ ਬਰਬਾਦ ਨਹੀਂ ਕਰਨਾ ਚਾਹੀਦਾ ਹਨ ਕਿਉਂਕਿ ਕੰਮ ਜ਼ਿਆਦਾ ਕਰਕੇ ਜਨਤਾ ਨੂੰ ਪ੍ਰੇਸ਼ਾਨੀਆਂ ਆਉਂਦੀਆਂ ਹਨ ਇਸ ਲਈ ਕੰਮ ਛੇ ਇਸ ਤਰ੍ਹਾਂ ਦਾ ਕਰਕੇ ਕਰੋ ਇਸ ਲਈ ਸਾਡੇ ਬੈਂਕਾਂ ਵਿੱਚ ਬਹੁਤ ਸਾਰੀ ਚੁਣੌਤੀਆਂ ਹਨ ਹੌਲੀ ਹੌਲੀ ਸਰਕਾਰ ਨੂੰ ਦੂਰ ਕਰਨਾ ਚਾਹੀਦਾ ਹੈ